ਸਾਡੇ ਪੰਜਾਬ ਦੇ ਤਿਉਹਾਰ ਜਿਵੇਂ ਕਿ ਹੋਲੀ ਵਿਸਾਖੀ ਦਿਵਾਲੀ ਦੁਸਹਿਰਾ ਸਾਰੇ ਹੀ ਬਹੁਤ ਸੈਲਾਨੀਆਂ ਲਈ ਲਾਜ਼ਮੀ ਹਨ ਅਤੇ ਦੂਰੋਂ ਦੂਰੋਂ ਇਹ ਲੋਕ ਇਸ ਤਿਉਹਾਰ ਦਾ ਆਨੰਦ ਮਾਨਣ ਲਈ ਅੰਮ੍ਰਿਤਸਰ ਗੋਲਡਨ ਟੈਂਪਲ ਆਉਂਦੇ ਹਨ